ਖੇਤੀ ਵਿੱਚ ਆਉਣ ਵਾਲੀ ਨਵੀਂ ਪੀੜ੍ਹੀ ਲਈ ਮੁੱਖ ਤੌਰ 'ਤੇ ਇਹ ਸੁਝਾਅ ਹੈ ਕਿ ਉਹਨਾਂ ਵੱਲੋਂ ਆਪਣੇ ਜੋਸ਼ ਦੇ ਨਾਲ ਨਾਲ ਹੋਸ਼ ਨੂੰ ਕਾਇਮ ਰੱਖਣਾ ਚਾਹੀਦਾ ਹੈ ਕਿਉਂਕਿ ਸਾਡੇ ਬਜ਼ੁਰਗਾਂ ਵੱਲੋਂ ਅਥਾਹ ਮਿਹਨਤ ਮੁਸ਼ੱਕਤ ਤੋਂ ਬਾਅਦ ਇਹ ਖੇਤ ਸਾਡੇ ਲਈ ਤਿਆਰ ਕੀਤੇ ਗਏ ਹਨ ਇਹਨਾਂ ਖੇਤਾਂ ਵਿੱਚ ਟਿੱਬਿਆਂ ਨੂੰ ਪੱਧਰਾ ਕੀਤਾ ਗਿਆ ਹੈ ਬਜ਼ੁਰਗਾਂ ਵੱਲੋਂ ਕਈ ਨੌਜਵਾਨਾਂ ਵੱਲੋਂ ਟਰੈਕਟਰਾਂ 'ਤੇ ਵੱਡੇ ਵੱਡੇ ਡੈੱਕ ਲਗਾ ਕੇ ਅਤੇ ਉਹ ਉਹਨਾਂ ਟਰੈਕਟਰਾਂ ਨੂੰ ਰੇਸਾਂ ਆਦਿ ਵਿੱਚ ਭਾਗ ਲਿਆ ਜਾਂਦਾ ਹੈ ਇਸ ਲਈ ਮਸ਼ੀਨਰੀ ਦਾ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ ਨਵੀਂ ਖੇਤੀ ਕਰਨ ਵਾਲੇ ਨੌਜਵਾਨਾਂ ਨੂੰ ਆਪਣੇ ਹੱਥੀਂ ਮਿਹਨਤ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਅਤੇ ਉਹਨਾਂ ਨੂੰ ਇਸ ਵਿੱਚ ਸੰਗ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਕਿਉਂਕਿ ਖੇਤੀ ਵਿੱਚ ਇੱਕ ਖਰਚੇ ਵੱਧ ਰਹੇ ਹਨ ਇਸ ਲਈ ਘੱਟ ਤੋਂ ਘੱਟ ਰੇਹਾਂ ਸਪਰੇਆਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜ਼ਰੂਰਤ ਪੈਣ 'ਤੇ ਹੀ ਖੇਤੀਬਾੜੀ ਯੂਨੀਵਰਸਿਟੀ ਨਾਲ ਰਾਬਤਾ ਕਾਇਮ ਕਰਨ ਉਪਰੰਤ ਹੀ ਰੇਹਾਂ ਅਤੇ ਸਪਰੇਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅੰਨੇਵਾਹ ਰੇਹਾਂ ਸਪਰੇਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਪਾਣੀ ਦੀ ਵਰਤੋਂ ਬੜੇ ਸੰਯਮ ਨਾਲ ਕਰਨੀ ਚਾਹੀਦੀ ਹੈ ਕਈ ਵਾਰ ਸਾਡੇ ਵੱਲੋਂ ਵ ਵੱਡੇ ਵੱਡੇ ਕਿਆਰੇ ਬਣਾ ਲਏ ਜਾਂਦੇ ਹਨ ਜਿਸ ਲਈ ਨਾਲ ਖੇਤਾਂ ਨੂੰ ਕਾਫੀ ਮਾਤਰਾ ਵਿੱਚ ਪਾਣੀ ਲੱਗਦਾ ਹੈ ਇਸ ਲਈ ਨੌਜਵਾਨਾਂ ਵੱਲੋਂ ਫੁਹਾਰਾ ਸਿੰਚਾਈ ਆਦਿ ਦੇ ਤਰੀਕਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਜਿਹੜਾ ਖੇਤੀ ਦਾ ਇੱਕ ਹੈ ਕਿ ਕਣਕ ਝੋਨੇ ਦੇ ਚੱਕਰ ਵਿੱਚੋਂ ਨਿਕਲ ਕੇ ਉਹਨਾਂ ਨੂੰ ਦਾਲਾਂ ਅਤੇ ਹੋਰ ਫ਼ਸਲਾਂ ਦੀ ਖੇਤੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀ ਧਰਤੀ ਬੜੀ ਹੀ ਉਪਜਾਊ ਅਤੇ ਜਰਖੇਜ਼ ਧਰਤੀ ਹੈ